ਮੋਬਾਈਲ ਫੋਨ ਗੱਲ ਬਾਤ ਕਰਨ ਦਾ ਇੱਕ ਬਹੁਤ ਹੀ ਸੌਖਾ ਜਰੀਆ ਹੈ ਇਸ ਦੇ ਰਾਹੀਂ ਅਸੀਂ ਜੇ ਕੋਈ ਦਿੱਲੀ ਦੱਖਣ ਜਾਂ ਕਨੇਡਾ ਬੈਠਾ ਹੈ ਜਾਂ ਆਸਟ੍ਰੇਲੀਆ ਬੈਠਾ ਹੈ ਉਸ ਨਾਲ ਵੀ ਸੰਪਰਕ ਕਰ ਸਕਦੇ ਹਾਂ ਅਤੇ ਉਸ ਨਾਲ ਵੀਡੀਓ ਕੌਲ ਵੀ ਕਰ ਸਕਦੇ ਹਾਂ ਮੋਬਾਈਲ ਫੋਨ ਦੇ ਕਈ ਸਾਰੇ ਲਾਭ ਵੀ ਹਨ ਜੇਕਰ ਮੈਨੂੰ ਮੇਰੀ ਪੜ੍ਹਾਈ ਵਿੱਚ ਥੋੜ੍ਹੀ ਵੀ ਦਿੱਕਤ ਆਉਂਦੀ ਹੈ ਤਾਂ ਮੈਂ ਇਸ ਤੋਂ ਸਰਚ ਕਰਦਾ ਹਾਂ ਅਤੇ ਉਹ ਮੇਰੀ ਦਿੱਕਤ ਸੁਲਝ ਜਾਂਦੀ ਹੈ ਜੇਕਰ ਮੈਂ ਕੋਈ ਚੀਜ਼ ਮੰਗਾਉਣੀ ਹੁੰਦੀ ਹੈ ਤਾਂ ਹੁਣ ਮੈਨੂੰ ਦੁਕਾਨ 'ਤੇ ਜਾਣ ਦੀ ਲੋੜ ਨਹੀਂ ਪੈਂਦੀ ਜੋਮੈਟੋ ਅਤੇ ਸਵਿਗੀ ਵਰਗੀਆਂ ਐਪਾਂ ਦੇ ਰਾਹੀਂ ਮੈਂ ਘਰ ਹੀ ਖਾਣਾ ਮੰਗਾ ਲੈਨਾ ਹਾਂ ਜੇਕਰ ਮੇਰੇ ਕੱਪੜੇ ਉੱਚੇ ਹੋ ਜਾਂਦੇ ਹਨ ਜਾਂ ਧੋਣ ਹੋਣ ਆਲੇ ਹੁੰਦੇ ਹਨ ਤਾਂ ਮੈਂ ਕੈਬ ਕਰਾ ਕੇ ਸ਼ਹਿਰ ਚਲਾ ਜਾਨਾ ਹਾਂ ਮੋਬਾਈਲ ਫੋਨ ਨੇ ਜੀਵਨ ਬਹੁਤ ਹੀ ਸੌਖਾ ਕਰ ਦਿੱਤਾ ਹੈ ਇਸ ਦੇ ਰਾਹੀਂ ਆਪਾਂ ਰੁਪਈਏ ਵੀ ਕਮਾ ਸਕਦੇ ਹਾਂ ਜਿਵੇਂ ਇਸ ਵਿੱਚ ਆਪਾਂ ਸ਼ੇਅਰ ਮਾਰਕੀਟ ਚਲਾ ਸਕਦੇ ਹਾਂ ਅਤੇ ਉਸ ਬਾਰੇ ਸਿੱਖਿਆ ਲੈ ਕੇ ਉਸ ਵਿੱਚ ਇਨਵੈਸਟ ਕਰ ਸਕਦੇ ਹਾਂ ਕਾਰੋਬਾਰ ਮੋਬਾਈਲ ਫੋਨ ਨਾਲ ਕਈ ਜਾਣਿਆਂ ਨੇ ਆਪਣਾ ਕਾਰੋਬਾਰ ਵੀ ਸ਼ੁਰੂ ਕੀਤਾ ਹੈ ਜਿਵੇਂ ਕਈ ਲੋਕਾਂ ਨੇ ਆਪਣਾ ਅਕਾਊਂਟ ਐਮਾਜ਼ੋਨ 'ਤੇ ਬਣਾ ਕੇ ਆਪਣੀ ਦੁਕਾਨਾਂ ਦੇ ਸਮਾਨ ਦੀ ਫੋਟੋ ਖਿੱਚ ਕੇ ਔਨਲਾਈਨ ਪਾ ਦਿੰਦੇ ਹਨ ਅਤੇ ਉਸ 'ਤੇ ਡਿਸਕਾਊਂਟ ਲਗਾ ਦਿੰਦੇ ਹਨ ਕਈਆਂ ਨੇ ਇੰਸਟਾਗ੍ਰਾਮ ਵਰਗੀਆਂ ਐਪਾਂ ਤੋਂ ਵੀ ਆਪਣਾ ਕਮਾਈ ਦਾ ਸਾਧਨ ਬਣਾ ਲਿਆ ਹੈ ਉਹ ਆਪਣੇ ਸਟੋਰ ਦੀਆਂ ਚੀਜ਼ਾਂ ਨੂੰ ਵੀਡੀਓ ਦੇ ਰਾਹੀਂ ਦਿਖਾਉਂਦੇ ਹਨ ਅਤੇ ਫਿਰ ਉਸ ਨੂੰ ਵੇਚਦੇ ਹਨ ਮੋਬਾਈਲ ਫੋਨ ਨਾਲ ਬਹੁਤ ਹੀ ਸ ਔਖੇ ਤੋਂ ਔਖਾ ਕੰਮ ਸੌਖਾ ਬਣ ਜਾਂਦਾ ਹੈ ਜੇਕਰ ਅਸੀਂ ਰਾਹ 'ਚ ਜਾਂਦੇ ਰਾਹ ਭਟਕ ਗਏ ਹਾਂ ਤਾਂ ਗੂਗਲ ਮੈਪ ਦੇ ਰਾਹੀਂ ਅਸੀਂ ਰਾਹ ਲੱਭ ਲੈਂਦੇ ਹਾਂ ਜੇਕਰ ਸਾਡੇ ਕੋਲ ਰੁਪਈਏ ਮੁੱਕ ਜਾਂਦੇ ਹਨ ਤਾਂ ਅਸੀਂ ਗੂਗਲ ਪੇਅ ਤੋਂ ਔਨਲਾਈਨ ਪੇਮੈਂਟ ਵੀ ਕਰ ਸਕਦੇ ਹਾਂ ਮੋਬਾਈਲ ਫੋਨ ਰਾਹੀਂ ਅਸੀਂ ਗੀਤ ਸੁਣ ਸਕਦੇ ਹਾਂ ਫ਼ਿਲਮਾਂ ਦੇਖ ਸਕਦੇ ਹਾਂ ਗੇਮਾਂ ਖੇਡ ਕੇ ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ ਇਸ ਵਿੱਚੋਂ ਸਾਨੂੰ ਸਿੱਖਿਆ ਵੀ ਮਿਲਦੀ ਹੈ ਜਿਵੇਂ ਕਈ ਵਾਰ ਮੈਂ ਔਨਲਾਈਨ ਪੜ੍ਹਦਾ ਹਾਂ ਤਾਂ ਔਨਲਾਈਨ ਪੜ੍ਹਾਈ ਵੀ ਸੌਖੀ ਹੈ ਅਤੇ ਇਸ ਵਿੱਚ ਡਾਊਟ ਵੀ ਕੋਹੀ ਕੋਈ ਨਹੀਂ ਰਹਿੰਦਾ